ਸਤਿ ਸ਼੍ਰੀ ਅਕਾਲ ਜੀ ਮੈਂ ਪੰਜਾਬ ਦੀ ਰਹਿਣ ਵਾਲੀ ਹਾਂ ਇਸ ਕਰਕੇ ਮੇਰਾ ਪਹਿਰਾਵਾ ਜਿਹੜਾ ਆ ਉਹ ਸੂਟ ਸਲਵਾਰ ਅਤੇ ਦੁਪੱਟਾ ਆ ਅਤੇ ਜਦੋਂ ਮ ਮੈਂ ਦੇਖਦੀ ਹਾਂ ਮੈਨੂੰ ਜ਼ਿਆਦਾਤਰ ਸੂਟ ਸਲਵਾਰ ਅਤੇ ਸੂਟ ਸਲਵਾਰ ਪਸੰਦ ਆ ਅਤੇ ਸੂਟ ਸਲਵਾਰ ਜਦੋਂ ਮੈਂ ਸੂਟ ਸਲਵਾਰ ਪਾਉਂਦੀ ਹਾਂ ਮੈਂ ਜ ਲਾਗੇ ਬੰਨੇ ਜਿੱਥੇ ਵੀ ਜਾਂਦੀ ਹਾਂ ਮੈਂ ਦੇਖਦੀ ਹਾਂ ਕਿ ਸਾਰਿਆਂ ਨੇ ਮੇਰੇ ਲਾਗੇ ਆਲੇ ਦੁਆਲੇ ਸਾਰਿਆਂ ਨੇ ਸੂ ਜੀਨਾਂ ਜੂਨਾਂ ਪਾਈਆਂ ਅਤੇ ਸੂਟ ਤਾਂ ਬਹੁਤ ਘੱਟ ਦਿਖਦੇ ਆ ਪਰ ਫਿਰ ਵੀ ਮੈਂ ਖੁਸ਼ ਹੁੰਦੀ ਹਾਂ ਕਿ ਮੈਂ ਉਹਨਾਂ ਸਾਰਿਆਂ ਵਿੱਚੋਂ ਸੂਟ ਪਾਇਆ ਹੁੰਦਾ ਆ ਐਂ ਸੋਹਣੀ ਬੜੀ ਚੁੰਨੀ ਲਿੱਤੀ ਹੁੰਦੀ ਆ ਐਸ ਮਤਲਬ ਮੈਂ ਉਹਨਾਂ ਸਭ ਤੋਂ ਵੱਖਰੀ ਜਿਹੀ ਲੱਗਦੀ ਹਾਂ ਜਦੋਂ ਮੈਂ ਸੂਟ ਪਾਉਂਦੀ ਹਾਂ ਨਾ ਮੈਂ ਖੁਦ ਨੂੰ ਇੱਕ ਪੂਰਾ ਮਹਿਸੂਸ ਕਰਦੀ ਹਾਂ ਕਿ ਮੈਂ ਆਪਣੇ ਆਪ ਵਿੱਚ ਹੁਣ ਪੂਰੀ ਹਾਂ ਅਤੇ ਮੈਂ ਜਦੋਂ ਸੂਟ ਸਲਵਾਰ ਪਾਉਂਦੀ ਹਾਂ ਮੈਨੂੰ ਬੜਾ ਵਧੀਆ ਲੱਗਦਾ ਆ ਸੂਟ ਸਲਵਾਰ ਪਾਉਣਾ ਅਤੇ ਮੈਂ ਜਦੋਂ ਜਦੋਂ ਵੀ ਮੈਂ ਸੂਟ ਸਲਵਾਰ ਪਾ ਕੇ ਅਤੇ ਨਿਕਲਦੀ ਹਾਂ ਜਾਂ ਮੇਰੇ ਸਿਰ 'ਤੇ ਜਦ ਚੁੰਨੀ ਹੁੰਦੀ ਆ ਨਾ ਤਾਂ ਮੈਨੂੰ ਬੜਾ ਵਧੀਆ ਲੱਗਦਾ ਮੈਨੂੰ ਚੰਗਾ ਲੱਗਦਾ ਜਿਹੜੀ ਚੁੰਨੀ ਆ ਉਹ ਤਾਂ ਪਹਿਲਾਂ ਹੀ ਸਾਡੇ ਘਰ ਪਰਿਵਾਰ ਦੇ ਬਾਰੇ ਦੱਸਦੀ ਆ ਕਿ ਮਤਲਬ ਪੁਰਾਣੇ ਬਜ਼ੁਰਗ ਕਹਿੰਦੇ ਸੀਗੇ ਕਿ ਜਿਹੜਾ ਮਤਲਬ ਬੰਦਾ ਆ ਨਾ ਜਿਹੜੀ ਜਿਹਦੇ ਸਿਰ 'ਤੇ ਚੁੰਨੀ ਆ ਉਹਦੇ ਘਰ 'ਤੇ ਉਹਦੇ ਸਿਰ 'ਤੇ ਸਿਰਫ ਚੁੰਨੀ ਨਹੀਂ ਆ ਉਹਦੇ ਸਿਰ 'ਤੇ ਜਿਹੜੇ ਆ ਘਰ ਦੀਆਂ ਸਾਰੀਆਂ ਜ਼ਿੰਮੇਦਾਰੀਆਂ ਆਂ ਅਤੇ ਮੈਂ ਕਹਿੰਦੀ ਹਾਂ ਕਿ ਉਹ ਜਿਹੜੀਆਂ ਜ਼ਿੰਮੇਦਾਰੀਆਂ ਨਾ ਉਹ ਵਾਕਿਆ ਮਹਿਸੂਸ ਹੁੰਦੀਆਂ ਜਦੋਂ ਸਿਰ 'ਤੇ ਚੁੰਨੀ ਹੁੰਦੀ ਆ ਅਤੇ ਸੋ ਸੂਟ ਸਲਵਾਰ ਤੋਂ ਵੱਖਰਾ ਮਤਲਬ ਸੂਟ ਸਲਵਾਰ ਤੋਂ ਜ਼ਿਆਦਾ ਵਧੀਆ ਕੋਈ ਕੱਪੜਾ ਹੀ ਨਹੀਂ ਆ ਮੈਨੂੰ ਲੱਗਦਾ ਹੈ ਕਿ ਇਹਦੇ 'ਚ ਬੰਦਾ ਕੱਜਿਆ ਰਹਿੰਦਾ ਹੈ ਢੱਕਿਆ ਰਹਿੰਦਾ ਕੁਛ ਦਿਖਦਾ ਨਹੀਂ ਆ ਸਭ ਮਤਲਬ ਕਿ ਵਧੀਆ ਰਹਿੰਦਾ ਆ ਧੰਨਵਾਦ